ਸਿਲਾਈ ਕਰਨਾ ਅਤੇ ਬੁਣਨਾ ਇਹ ਦੋਨੇ ਹੀ ਮੈਨੂੰ ਆਉਂਦੇ ਨੇ ਪਰ ਅਸੀ ਸਿਲਾਈ ਕਰਨਾ ਸਿਲਾਈ ਕਰਨ ਵੇਲੇ ਮੈਂ ਇੱਕ ਮਹੀਨਾ ਲਗਾਇਆ ਸੀਗਾ ਕਿਸੇ ਬੁਟੀਕ ਦੇ ਉੱਤੇ ਤਾਂ ਉੱਥੇ ਮਤਲਬ ਪੰਦਰਾਂ ਪੰਦਰਾਂ ਦਿਨ ਤਾਂ ਉਹਨਾਂ ਨੇ ਪੂਰਾ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਅਖਬਾਰ ਦੇ ਉੱਤੇ ਉਹ ਨਿਸ਼ਾਨੀਆਂ ਲਾ ਲਾ ਕੇ ਉਹਨਾਂ ਨੇ ਸਿਖਾਇਆ ਪੰਦਰਾਂ ਕੁ ਦਿਨ ਅਤੇ ਪੰਦਰਾਂ ਦਿਨਾਂ ਬਾਅਦ ਉਹਨਾਂ ਨੇ ਜਿੱਦਾਂ ਆਪਣੇ ਇੱਦਾਂ ਘਰੇ ਕੱਪੜਾ ਹੁੰਦਾ ਜਿੱਦਾਂ ਕੋਈ ਵੀ ਸੂਟ ਇੱਦਾਂ ਤਾਂ ਉਹਦਾ ਜਿੱਦਾਂ ਪਹਿਲਾਂ ਸਾਨੂੰ ਇਕੱਲਾ ਕਮੀਜ਼ ਬਣਾਉਣਾ ਫਿਰ ਆਪਾਂ ਕਹਿ ਲਈਏ ਸਰਵਾਲ ਬਣਾਉਣੀ ਫਿਰ ਸਲਵਾਰ ਦੇ ਵਿੱਚ ਆਪਾਂ ਕਹਿ ਲਈਏ ਬੋਟਮ ਦੇ ਵਿੱਚ ਆਪਾਂ ਅੱਜ ਕੱਲ੍ਹ ਪਲਾਜ਼ੋ ਬਣਾ ਲੈਂਦੇ ਹਾਂ ਹੈ ਨਾ ਤਾਂ ਪਲਾਜ਼ੋ ਦੀ ਕਟਿੰਗ ਹੋ ਗਈ ਸਲਵਾਰ ਦੀ ਕਟਿੰਗ ਹੋ ਗਈ ਤਾਂ ਉਹ ਚੀਜ਼ਾਂ ਸਿਖਾਈਆਂ ਤਾਂ ਪਹਿਲਾਂ ਜਿਹੜਾ ਵੀ ਇੱਕ ਯਾਦਗਾਰੀ ਪਲ ਮੈਂ ਜੇ ਸਾਂਝਾ ਕਰਾਂ ਤਾਂ ਜਿੱਦਾਂ ਪਹਿਲਾਂ ਮੈਂ ਕਿਸੇ ਕੱਪੜੇ ਦੇ ਉੱਤੇ ਸੀ ਇੱਦਾਂ ਸਿਖ ਰਾਹੀ ਸੀ ਤਾਂ ਉਹ ਕੱਪੜੇ ਦੇ ਵਿੱਚ ਕੀ ਸੀ ਕਈ ਵਾਰੀ ਕਾਰਡ ਜ ਜ਼ਿਆਦਾ ਪੈ ਗਈ ਜਾਂ ਆਪਾਂ ਕਹਿ ਲਈਏ ਵੀ ਕੱਪੜਾ ਮਤਲਬ ਖਰਾਬ ਹੋ ਰਿਹਾ ਸੀ ਜ਼ਿਆਦਾ ਤਾਂ ਫਿਰ ਜਿਹੜੇ ਉਹ ਸਿਖਾਉਣ ਵਾਲੇ ਆਂਟੀ ਸੀਗੇ ਉਹ ਮਤਲਬ ਰਿਸ਼ਤੇਦਾਰੀ 'ਚੋਂ ਤਾਂ ਉਹ ਜਿਹੜੇ ਆਂਟੀ ਸੀਗੇ ਉਹ ਕਹਿੰਦੇ ਵੀ ਬੇਟਾ ਵੀ ਤੁਸੀਂ ਅਖਬਾਰ ਹੁੰਦਾ ਜਿਹੜਾ ਪਹਿਲਾਂ ਉਹਦੇ ਉੱਤੇ ਵੀ ਨਿਸ਼ਾਨੀਆਂ ਲਾ ਕੇ ਤੁਸੀਂ ਫਿਰ ਸਿੱਖੋ ਤਾਂ ਮਤਲਬ ਉਹ ਇੱਕ ਬਹੁਤ ਵਧੀਆ ਯਾਦਗਾਰੀ ਪਲ ਸੀਗਾ ਜਿਹੜਾ ਉਹਨਾਂ ਨੇ ਮਤਲਬ ਵੀ ਇੱਦਾਂ ਸਿਖਾਇਆ ਤਾਂ ਮਤਲਬ ਇਹਦੇ 'ਚ ਸੁਝਾਅ ਅਸੀਂ ਇਹ ਦੇ ਸਕਦੇ ਹਾਂ ਜਿੱਦਾਂ ਅੱਜ ਕੱਲ੍ਹ ਜੇ ਆਪਾਂ ਕਹਿ ਲਈਏ ਵੀ ਜਿਵੇਂ ਇਹ ਬੁਟੀਕ ਹੋ ਗਏ ਨਾ ਵੀ ਇਹ ਇੱਕ ਬਿਜ਼ਨਸ ਬਣ ਗਿਆ ਮਤਲਬ ਆਪਾਂ ਕਹਿ ਲਈਏ ਤਾਂ ਇਹ ਜਿਵੇਂ ਹੁਣ ਘਰੇਲੂ ਆਪਣੀਆਂ ਜਿਹੜੀਆਂ ਵੀ ਔਰਤਾਂ ਨੇ ਉਹ ਜ਼ਿਆਦਾ ਜਿਹੜੇ ਪੜ੍ਹੇ ਲਿਖੇ ਨਹੀਂ ਹੁੰਦੇ ਹੈ ਨਾ ਤਾਂ ਉਹਨਾਂ ਵਿੱਚ ਇਹ ਇੱਕ ਹੁਨਰ ਤਾਂ ਹੈ ਨਾ ਵੀ ਸਿਲਾਈ ਕਰਨਾ ਅਤੇ ਬੁਣਨਾ ਇਹ ਇੱਕ ਮਤਲਬ ਮੈਂ ਕਹਿ ਸਕਦੀ ਹਾਂ ਵੀ ਬਹੁਤ ਵੱਡਾ ਹੁਨਰ ਹੈ ਜੇ ਤੁਹਾਨੂੰ ਆਉਂਦਾ ਤਾਂ ਇਹਨੂੰ ਮਤਲਬ ਮੈਨੂੰ ਲੱਗਦਾ ਵੀ ਆਪਾਂ ਨੂੰ ਸਿਖਾਉਣਾ ਵੀ ਚਾਹੀਦਾ 'ਤੇ ਇੱਕ ਇਹਦੇ 'ਚ ਕੀ ਹੈ ਇਹ ਤੁਹਾਡੀ ਕਮਾਈ ਵੀ ਹੈਗੀ ਆ ਮਤਲਬ ਤੁਹਾਡੀ ਅਰਨਿੰਗ ਵੀ ਹੈਗੀ ਹੈ ਤੁਸੀਂ ਇਹਦੇ ਨਾਲ ਕਮਾ ਸਕਦੇ ਹੋ ਤਾਂ ਇਹ ਇੱਕ ਆਪਾਂ ਕਹਿ ਲਈਏ ਵੀ ਬਿਜ਼ ਮਤਲਬ ਆਪਾਂ ਵੀ ਮਤਲਬ ਆਪਾਂ ਕਹਿ ਲਈਏ ਬਿਜ਼ਨਸ ਆਪਾਂ ਇੱਦਾਂ ਕਰ ਸਕਦੇ ਹਾਂ ਤਾਂ ਇਹਦੇ ਵਿੱਚ ਹੁਣ ਆਪਾਂ ਅੱਜ ਕੱਲ੍ਹ ਦੇਖੇ ਹੋਣੇ ਆ ਵੀ ਹਰ ਥਾਂ ਥਾਂ ਉੱਤੇ ਬੁਟੀਕ ਖੁੱਲ੍ਹੇ ਹੋਏ ਆ ਹੈ ਨਾ ਇੱਦਾਂ ਤਾਂ ਇਹ ਕਿਤੇ ਨਾ ਕਿਤੇ ਵੀ ਆਪਾਂ ਕਹਿ ਲਈਏ ਵੀ ਇਹ ਚੰਗੀ ਗੱਲ ਹੈ ਵੀ ਜਿਹੜੀਆਂ ਆਪਣੀਆਂ ਹੁਣ ਵੀ ਘਰੇਲੂ ਘਰ ਆਪਣੀਆਂ ਰਹਿੰਦੀਆਂ ਨੇ ਹੈ ਨਾ ਜਿੱਦਾਂ ਔਰਤਾਂ ਤਾਂ ਵੀ ਉਹ ਵੀ ਥੋੜ੍ਹਾ ਅੱਗੇ ਆ ਰਹੀਆਂ ਨੇ ਹੈ ਨਾ ਉਹਨਾਂ ਦੇ ਵਿੱਚ ਵੀ ਆਪਾਂ ਕਹਿ ਲਈਏ ਵੀ ਕੋਨਫੀਡੈਂਸ ਆ ਜਿਹੜਾ ਹੈ ਨਾ ਥੋੜ੍ਹਾ ਵੱਧ ਰਿਹਾ ਤਾਂ ਇਹੋ ਜਿਹੀਆਂ ਜਿਹੜੀਆਂ ਸਿਲਾਈ ਕਢਾਈ ਹੋ ਗਈ ਹੈ ਨਾ ਵੀ ਇਹੋ ਜਿਹੇ ਜਿਹੜੇ ਜਿੱਦਾਂ ਹੁਣ ਉਹ ਵੀ ਹੋ ਗਈਆਂ ਖਾਣਾ ਬਣਾਉਣਾ ਕੁਕਿੰਗ ਦੇ ਵਿੱਚ ਕਿੰਨੀਆਂ ਰੈਸਪੀ ਆ ਹੈ ਨਾ ਤਾਂ ਉਹ ਵੀ ਆਪਾਂ ਜੇ ਇੱਦਾਂ ਸ਼ੇਅਰ ਕਰਦੇ ਹਾਂ ਤਾਂ ਇਹ ਇਹਦੇ 'ਚ ਕੀ ਹੈ ਇੱਕ ਤਾਂ ਆਪਣਾ ਜਿਹੜਾ ਸੈਲਫ ਕੋਨਫੀਡੈਂਸ ਹੁੰਦਾ ਉਹਦੇ 'ਚ ਵਾਧਾ ਹੁੰਦਾ ਬਾਕੀ ਆਪਣੀ ਕੀ ਆਪਣੀ ਕਮਾਈ ਦਾ ਇੱਕ ਇਹ ਸਾਧਨ ਵੀ ਹੁੰਦਾ ਤਾਂ ਬਾਕੀ ਅੱਜ ਕੱਲ੍ਹ ਦੇ ਇੰਨੇ ਮਹਿੰਗਾਈ ਦੇ ਦੌਰ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਹਰ ਕਿਸੇ ਨੂੰ ਆਪਣੇ ਜਿੱਦਾਂ ਘਰਾਂ ਦੇ ਵਿੱਚ ਬਜ਼ੁਰਗ ਵੀ ਹੈਗੇ ਨੇ ਜਾਂ ਕੋਈ ਵੀ ਆ ਵੀ ਜੇ ਆਪ ਦਾ ਇੱਕ ਇੱਦਾਂ ਸਾਧਨ ਹੁੰਦਾ ਅਰਨਿੰਗ ਦਾ ਹੈ ਨਾ ਤਾਂ ਉਹ ਚੰਗੀ ਗੱਲ ਹੈ